ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਤਰ੍ਹਾਂ ਦੀਆਂ ਮੁੱਖ ਚੁਣੌਤੀਆਂ ਹਨ ਸਕੂਲ ਟਾਈਮ ਵਿੱਚ ਜਦੋਂ ਅਸੀਂ ਪੜ੍ਹਾਈ ਕਰਦੇ ਸਨ ਤਾਂ ਸਾਨੂੰ ਅਧਿਆਪਕ ਕਈ ਤਰ੍ਹਾਂ ਦੀਆਂ ਖੇਡਾਂ ਬਾਰੇ ਦੱਸਦੇ ਸਨ ਜਿਵੇਂ ਖੋ ਖੋ ਕਬੱਡੀ ਬੈਂਡਮੈਟਨ ਵਾਲੀਵਾਲ ਆਦਿ ਖੇਡਾਂ ਇਹ ਖੇਡਾਂ ਸਾਨੂੰ ਖੇਡ ਕੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਸਨ ਸਭ ਤੋਂ ਪਹਿਲਾਂ ਸਾਨੂੰ ਖੋ ਖੋ ਸਿਖਾਈ ਜਾਂਦੀ ਸੀ ਇੱਕ ਟੀਮ ਤੋਂ ਦੂਜੀ ਟੀਮ ਨਾਲ਼ ਸਾਡਾ ਮੁਕਾਬਲਾ ਸ਼ੁਰੂ ਹੁੰਦਾ ਸੀ ਜਿਹੜੀ ਟੀਮ ਜਿੱਤ ਜਾਂਦੀ ਸੀ ਉਸ ਨੂੰ ਇਨਾਮੀ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ ਕਿ ਇਸ ਖੇਡ ਨੂੰ ਬਹੁਤ ਹੀ ਚੰਗੇ ਢੰਗ ਨਾਲ਼ ਖੇਡਿਆ ਜਾਵੇ ਤਾਂ ਤਾਂ ਬੰਦਾ ਅੱਗੇ ਜਾ ਕੇ ਬਹੁਤ ਹੀ ਵੱਡਾ ਖਿਡਾਰੀ ਵੀ ਬਣ ਸਕਦਾ ਹੈ ਅਧਿਆਪਕਾਂ ਨੇ ਸਾਨੂੰ ਬਹੁਤ ਜ਼ਿਆਦਾ ਪਾਠ ਪੜ੍ਹਾਏ ਕਿ ਜਿਸ ਤੋਂ ਅਸੀਂ ਅੱਗੇ ਜਾ ਕੇ ਮਾਰ ਨਾ ਖਾ ਸਕੀਏ ਸਾਨੂੰ ਅਧਿਆਪਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਭਾਰਤ ਦੀਆਂ ਜਿੰਨੀਆਂ ਵੀ ਚੁਣੌਤੀਆਂ ਹਨ ਉਹਨਾਂ ਵਿੱਚ ਫਤਹਿ ਹਾਸਲ ਕਰਨੀ ਪੈਂਦੀ ਹੈ ਇਸ ਕਰਕੇ ਸਕੂਲਾਂ ਵਿੱਚ ਅਲੱਗ ਅਲੱਗ ਸਰਕਾਰੀ ਸਕੂਲਾਂ ਵਿੱਚ ਵੀ ਸਰਕਾਰੀ ਸਕੂਲਾਂ ਵਿੱਚ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜੋ ਕਿ ਸਾਡੀ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਦਰਸਾਉਂਦੀਆਂ ਹਨ ਇਸ ਕਰਕੇ ਕੁਝ ਮੁੱਖ ਚੁਣੌਤੀਆਂ ਹੋਰ ਵੀ ਹਨ ਜੋ ਕਿ